ਹਾਂ ਇੱਕ ਸਿੱਖਿਅਤ ਵਿਅਕਤੀ ਚੰਗੇ ਵਿਵਹਾਰ ਅਤੇ ਸਿਧਾਂਤਾਂ ਦੀ ਪਾਲਣਾ ਕਰਦਾ ਹੈ ਸਿੱਖਿਅਤ ਵਿਅਕਤੀ ਦੇ ਸਿੱਖਣ ਦਾ ਸਤਰ ਉੱਚਾ ਹੁੰਦਾ ਹੈ ਉਸਨੂੰ ਚੰਗੇ ਮਾੜੇ ਵਿਵਹਾਰ ਦੀ ਸਮਝ ਹੁੰਦੀ ਹੈ ਉਹ ਆਪਣੇ ਹੱਕਾਂ ਦੇ ਨਾਲ ਨਾਲ ਆਪਣੇ ਫਰਜ਼ਾਂ ਪ੍ਰਤੀ ਵੀ ਜਾਗਰੂਕ ਹੁੰਦਾ ਹੈ ਉਹ ਚੰਗੇ ਨਾਗਰਿਕ ਦੀ ਭੂਮਿਕਾ ਨਿਭਾਉਂਦਿਆ ਚੰਗੇ ਵਿਵਹਾਰ ਅਤੇ ਸਿਧਾਂਤਾਂ ਦੀ ਪਾਲਣਾ ਕਰਦਾ ਹੈ